ਖੇਡ ਵਿਭਾਗ ਵਿੱਚ ਬਹੁਤ ਸਾਰੀਆਂ ਸਕੋਲਰਸ਼ਿਪਾਂ ਮਿਲਦੀਆਂ ਹਨ ਜਿਸ ਨਾਲ ਖਿਡਾਰੀਆਂ ਨੂੰ ਬਹੁਤ ਉਤਸ਼ਾਹ ਮਿਲਦਾ ਹੈ ਧਿਆਨ ਚੰਦ ਸਕੋਲਰਸ਼ਿਪ ਜੋ ਕਿ ਸਟੇਟ ਲੈਵਲ 'ਤੇ ਖੇਡਣ ਵਾਲੇ ਖਿਡਾਰੀਆਂ ਨੂੰ ਦਿੱਤੀ ਜਾਂਦੀ ਹੈ ਇਸ ਵਿੱਚ ਸਾਲ ਦਾ ਤੀਹ ਹਜ਼ਾਰ ਰੁਪਏ ਦਿੱਤਾ ਜਾਂਦਾ ਹੈ ਇਸ ਵਿੱਚੋਂ ਫਰੂਟ ਅਤੇ ਡਰਾਈ ਫਰੂਟ ਦਾ ਖਰਚਾ ਅਲੱਗ ਹੁੰਦਾ ਹੈ ਅਤੇ ਪੌਸ਼ਟਿਕ ਮੀਲ ਦਾ ਪ੍ਰਬੰਧ ਅਲੱਗ ਤੋਂ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਮਿਲਖਾ ਸਿੰਘ ਸਕੋਲਰਸ਼ਿਪ ਵੀ ਹੈ ਜਿਸ ਵਿੱਚ ਖਿਡਾਰੀਆਂ ਨੂੰ ਦਸ ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਅਤੇ ਉਹਨਾਂ ਨੂੰ ਸਹੂਲਤ ਮਿਲਦੀ ਹੈ ਜਿਸ ਵਿੱਚ ਉਹਨਾਂ ਨੂੰ ਖੇਡਣ ਦਾ ਵੀ ਮਿਲਦੇ ਹਨ